ਕੱਲ੍ਹ ਮੇਰੇ ਭੰਗੜੇ ਦਾ ਪਹਿਲਾ ਦਿਨ ਸੀ ਇਸ ਕਰਕੇ ਮੈਂ ਕੱਲ੍ਹ ਭੰਗੜਾ ਕਰਨ ਗਈ ਜੋ ਕਿ ਮੇਰੀ ਸਹੇਲੀ ਨੇ ਮੈਨੂੰ ਦੱਸਿਆ ਸੀ ਵੀ ਇੱਥੇ ਭੰਗੜਾ ਕਲਾਸਿਸ ਲੱਗਦੀਆਂ ਅਤੇ ਉਸਨੇ ਮੈਨੂੰ ਭੰਗੜਾ ਕਲਾਸਿਸ ਦੱਸੀਆਂ ਸੀ ਅਤੇ ਮੈਂ ਉੱਥੇ ਗਈ ਸੀ ਅਤੇ ਉੱਥੇ ਪਹਿਲਾਂ ਤਾਂ ਜਾਣ ਦੇ ਵਿੱਚ ਮੈਨੂੰ ਬੜੀ ਘਬਰਾਹਟ ਹੁੰਦੀ ਪਈ ਸੀ ਵੀ ਪਹਿਲਾਂ ਦਿਨ ਕਰਕੇ ਤੇ ਅਤੇ ਮੈਂ ਜੀਨ ਟੋਪ ਪਾ ਕੇ ਗਈ ਸੀ ਅਤੇ ਮੈਨੂੰ ਪਹਿਲਾ ਦਿਨ ਨਾ ਬੜਾ ਹੀ ਡਰ ਲੱਗਦਾ ਸੀ ਵੈਸੇ ਤਾਂ ਮੈਨੂੰ ਕੁਝ ਡਾਂਸ ਆਉਂਦਾ ਨਹੀਂ ਸੀ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਘਬਰਾਹਟ ਹੋ ਰਹੀ ਸੀ ਹਾਏ ਮੇਰੀ ਉੱਥੇ ਜਾ ਕੇ ਬੇਇੱਜ਼ਤੀ ਨਾ ਹੋ ਜਾਵੇ ਵੀ ਆਹ ਕੁਝ ਵੀ ਡਰ ਤਾਂ ਹੁੰਦਾ ਹੀ ਹੈ ਪਹਿਲੇ ਵਾਰੀ ਤਾਂ ਫਿਰ ਮੈਨੂੰ ਡਰ ਲੱਗ ਰਿਹਾ ਸੀ ਅਤੇ ਫਿਰ ਮੈਂ ਉੱਥੇ ਜਦੋਂ ਗਈ ਤਾਂ ਮੈਨੂੰ ਮੇਰੀ ਟੀਚਰ ਨੇ ਅਤੇ ਮੇਰੀ ਸਹੇਲੀ ਨੇ ਮੈਨੂੰ ਕਿਹਾ ਵੀ ਡਰ ਨਾ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਇੱਦਾਂ ਹੁੰਦਾ ਤੂੰ ਟੈਂਸ਼ਨ ਨਾ ਲੈ ਅਤੇ ਤੂੰ ਆਰਾਮ ਨਾਲ ਖ ਖੁੱਲ੍ਹ ਜਾ ਮੈ ਖੁੱਲ੍ਹੇ ਮਾਈਂਡ ਨਾਲ ਇੱਥੇ ਭੰਗੜਾ ਕਰ ਫਿਰ ਜਦੋਂ ਮੇਰੀ ਭ ਜਦੋਂ ਮੈਂ ਭੰਗੜਾ ਕਰਨ ਲੱਗੀ ਮੈਨੂੰ ਫਟਾਫਟ ਮੈਨੂੰ ਸਾਹ ਚੜ੍ਹਨ ਲੱਗ ਗਿਆ ਹੋਰ ਵੀ ਮੇਰੇ ਸਾਹ ਫੁੱਲਣ ਲੱਗ ਗਿਆ ਅਤੇ ਫਿਰ ਜਦੋਂ ਮੈਨੂੰ ਮੇਰੀ ਮੈ ਅਧਿਆਪਕ ਨੇ ਦੱਸਿਆ ਕਿ ਵੀ ਅਜੇ ਭੰਗੜਾ ਕਰਨ ਤੋਂ ਪਹਿਲਾਂ ਨਾ ਸਰੀਰ ਨੂੰ ਥੋੜ੍ਹਾ ਗਰਮ ਕਰਨਾ ਪੈਂਦਾ ਇਸ ਕਰਕੇ ਥੋੜ੍ਹਾ ਜਿਹਾ ਵੋਮਅਪ ਕਰ ਲੈ ਕਸਰਤ ਵੀ ਇਸ ਭੰਗੜੇ ਤੋਂ ਪਹਿਲਾਂ ਕਸਰਤ ਕਰਨੀ ਵੀ ਜ਼ਰੂਰੀ ਹੁੰਦੀ ਹੈ ਜਿਸ ਨਾਲ ਸਰੀਰ ਦੀਆਂ ਸਰੀਰ ਦੀਆਂ ਮਤਲਬ ਕਿ ਸਾਰੀਆਂ ਮਤਲਬ ਕਿ ਤਨ ਮਨ ਖੁੱਲ੍ਹ ਜਾਂਦਾ ਹੈ ਅਤੇ ਜਿਸ ਨਾਲ ਆਪਾਂ ਆਰਾਮ ਆਰਾਮ ਨਾਲ ਭੰਗੜਾ ਕਰ ਸਕਦੇ ਹਾਂ ਫਿਰ ਉਸ ਫਿਰ ਉਸ ਤੋਂ ਬਾਅਦ ਮੈਂ ਭੰਗੜਾ ਕਰਨਾ ਸ਼ੁਰੂ ਕੀਤਾ ਜਿਸ 'ਚ ਮੈਨੂੰ ਬਹੁਤ ਮਜ਼ਾ ਆਇਆ ਪਰ ਮੇਰੇ ਪਰ ਕੀ ਕਹਿੰਦੇ ਆ ਭੰਗੜਾ ਕਰਨ ਤੋਂ ਬਾਅਦ ਮੇਰੇ ਨਾ ਆਉਣ ਘਰ ਆ ਕੇ ਨਾ ਮੇਰੇ ਖੱਲੀਆਂ ਲੱਤਾਂ ਬਾਹਾਂ ਬਹੁਤ ਦੁਖਣ ਲੱਗ ਗਈਆਂ ਪਰ ਮੇਰੇ ਅਧਿਆਪਕ ਨੇ ਕਿਹਾ ਸੀ ਪਹਿਲੇ ਕੁਝ ਕੁ ਦਿਨ ਤੇਰੀਆਂ ਲੱਤਾਂ ਬਾਹਾਂ ਅਤੇ ਖੱਲੀਆਂ ਪੈਣਗੀਆਂ ਹੀ ਅਤੇ ਮੈਨੂੰ ਇਹ ਵੀ ਗੱਲ ਕਹੀ ਵੀ ਕੱਪੜੇ ਥੋੜ੍ਹੇ ਜਿਹੇ ਖੁੱਲ੍ਹੇ ਪਾ ਕੇ ਆਇਆ ਕਰਨੇ ਆ ਮੈਂ ਪਹਿਲੇ ਦਿਨ ਜੀਨ ਟੋਪ ਪਾ ਗਈ ਸੀ ਮੈਨੂੰ ਪਤਾ ਨਹੀਂ ਸੀ ਇਸ ਕਰਕੇ ਮੈਂ ਕੱਲ੍ਹ ਤੋਂ ਖੁੱਲ੍ਹੇ ਜਿਵੇਂ ਸਲਵਾਰ ਕਮੀਜ਼ ਆ ਖੁੱਲ੍ਹੇ ਲੋਅਰ ਟੀ ਸ਼ਰਟ ਜਿਹਾ ਪਾ ਕੇ ਜਾਇਆ ਕਰੂੰਗੀ ਜਿ ਜਿਸ 'ਚ ਮੈਂ ਆਰਾਮ ਨਾਲ ਆਰਾਮਦਾਇਕ ਨਾਲ ਭੰਗੜਾ ਕਰ ਸਕਾਂ ਤੇ ਅਤੇ ਹੋਰ ਵੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਭੰਗੜੇ ਦੇ ਵਿੱਚ ਤੇ ਅਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਪਹਿਲੇ ਚਾਰ ਪੰਜ ਦਿਨ ਲੱਤਾਂ ਦੁਖਣਗੀਆਂ ਹੱਡੀਆਂ ਦੁਖਣਗੀਆਂ ਮਤਲਬ ਕਿ ਖੱਲੀਆਂ ਖੁੱਲੀਆਂ ਪੈਣਗੀਆਂ ਅਤੇ ਇਹ ਕੋਈ ਨਹੀਂ ਇਸ ਨੂੰ ਇਸ ਨੂੰ ਧਿਆਨ ਨਾ ਦਿਓ ਅਤੇ ਜੇ ਤੁਸੀਂ ਰੋਜ਼ ਰੋਜ਼ ਇਹ ਚੀਜ਼ ਕਰਦੇ ਰਹੋਗੇ ਤੁਹਾਡੀਆਂ ਖੱਲੀਆਂ ਖੁੱਲ੍ਹ ਜਾਣਗੀਆਂ ਤੁਹਾਨੂੰ ਇਸ ਚੀਜ਼ ਦੀ ਆਦਤ ਬਣ ਜਾਊਗੀ ਧੰਨਵਾਦ